ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਜਿਸ ਦੇ ਭਿੰਨ ਭਿੰਨ ਪ੍ਰਾਂਤਾਂ ਵਿੱਚ ਭਿੰਨ ਭਿੰਨ ਨਾਚ ਸ਼ੈਲੀਆਂ ਦੇ ਰੂਪ ਹਨ ਜਿਨ੍ਹਾਂ ਦੇ ਵਿੱਚ ਗਿੱਧਾ ਭੰਗੜਾ ਕਲਾਸੀਕਲ ਫੋਕ ਡਾਂਸ ਹਿਪਹੋਪ ਆਦਿ ਹਨ ਇਹ ਬਹੁਤ ਹੀ ਪ੍ਰਚਲਿਤ ਹਨ ਇਸ ਤੋਂ ਇਲਾਵਾ ਮੈਂ ਇੱਕ ਮਸ਼ਹੂਰ ਡਾਂਸਰ ਨੂੰ ਜਾਣਦੀ ਹਾਂ ਜਿਸ ਦਾ ਨਾਮ ਮਾਧੁਰੀ ਦੀਕਸ਼ਿਤ ਹੈ ਉਹ ਬਹੁਤ ਵੱਡੀ ਐਕਟਰ ਹੈ ਅਤੇ ਉਸਨੇ ਬਹੁਤ ਹੀ ਹਿੰਦੀ ਫਿਲਮਾਂ ਵਿੱਚ ਆਪਣੇ ਡਾਂਸ ਦੇ ਕਰਤੱਵ ਦਿਖਾਏ ਹਨ ਮੈਂ ਉਸਨੂੰ ਅਕਸਰ ਫਿਲਮਾਂ ਵਿੱਚ ਦੇਖਿਆ ਹੈ ਮੈਂ ਉਸਨੂੰ ਬਹੁਤ ਜਿਆਦਾ ਪਸੰਦ ਕਰਦੀ ਹਾਂ ਮੈਂ ਉਹਦੀਆਂ ਅਕਸਰ ਫਿਲਮਾਂ ਦੇਖਦੀ ਰਹਿੰਦੀ ਹਾਂ